ਮੈਂ ਡੈਡੀ ਤੋਂ ਪੁੱਛਿਆ ਵੀ ਮੈਂ ਆਈ ਆਈ ਟੀ ਰੋਪੜ ਵਿੱਚ ਕੰਮ ਕਰ ਲਵਾਂ ਵੀ ਕਿੱਦਾਂ ਤੁਹਾਨੂੰ ਦੱਸੋ ਤੁਸੀਂ ਕਿੱਦਾਂ ਸਹੀ ਹੈ ਡੈਡੀ ਕਹਿੰਦੇ ਤਾਂ ਸਹੀ ਆ ਕੰਮ ਆਈ ਆਈ ਟੀ ਰੋਪੜ ਵਿੱਚ ਬਹੁਤ ਜ਼ਿਆਦਾ ਵਧੀਆ ਹੈਗੇ ਆ ਸੰਸਥਾ ਅਤੇ ਬਹੁਤ ਵਧੀਆ ਉੱਥੇ ਕੋਈ ਕੰਮ ਕਰਨੇ 'ਚ ਨਾ ਦਿੱਕਤ ਆਉਂਦੀ ਆ ਨਾ ਪੈਸੇ 'ਚ ਕੋਈ ਪਰੇਸ਼ਾਨੀ ਆਉਂਦੀ ਆ ਵਧੀਆ ਤਰੀਕੇ ਨਾਲ ਸੈਲਰੀ ਮਿਲਦੀ ਆ ਹਰ ਮਹੀਨੇ ਟਾਇਮ ਨਾਲ ਸੈਲਰੀ ਮਿਲ ਜਾਂਦੀ ਹੈ